ਹੈਲੋ ਹਾਂਜੀ ਮੈਮ ਸਤਿ ਸ਼੍ਰੀ ਅਕਾਲ ਜੀ ਹਾਂਜੀ ਜੀ ਹਾਂਜੀ ਹਾਂਜੀ ਜੀ ਜੀ ਜੀ ਮੈਮ ਤੁਹਾਡੇ ਬਜਟ 'ਤੇ ਡਿਪੈਂਡ ਕਰਦਾ ਨਾ ਤੁਸੀਂ ਬਜਟ ਦੱਸੋ ਆਪਣਾ ਅਸੀਂ ਉਸੇ ਹਿਸਾਬ ਨਾਲ਼ ਤੁਹਾਨੂੰ ਦੱਸ ਦਵਾਂਗੇ ਅੱਛਾ ਜੀ ਉਹਦੇ ਵਿੱਚ ਤੁਹਾਨੂੰ ਫੰਕਸ਼ਨ ਹਲਦੀ ਚਾਹੀਦੀ ਹੈ ਜਾਗੋ 'ਤੇ ਹੋਰ ਕੀ ਚਾਹੀਦਾ ਠੀਕ ਹੈ ਜੀ ਜੀ ਹੋਰ ਚੋਇਸ ਤੁਹਾਡੀ ਕੀ ਕੀ

ਠੀਕ ਹੈ ਜੀ ਜੀ ਜੀ ਠੀਕ ਹੈ ਜੀ ਦੇਖੋ ਮੈਮ ਤੁਹਾਨੂੰ ਨਾ ਇੱਕ ਸਟੋਲ ਜਿਹੜਾ ਜੀ ਜੀ ਇੱਕ ਸਟੋਲ ਜਿਹੜਾ ਹੈ ਉਹ ਤੁਹਾਨੂੰ ਪਏਗਾ ਦੋ ਹਜ਼ਾਰ ਤੋਂ ਪੱਚੀ ਸੌ ਦੇ ਵਿੱਚ ਠੀਕ ਹੈ ਜੀ ਕੋਈ ਨਾ ਬਾਕੀ ਤੁਹਾਡੇ ਬਜਟ ਦੇ ਹਿਸਾਬ ਨਾਲ਼ ਹੋ ਜਾਵੇਗਾ ਮੈਮ ਜਿੱਦਾਂ ਵੀ ਤੁਸੀਂ ਚਾਹੋਗੇ ਹਾਂਜੀ ਉਦਾਂ ਹੋਜੇਗਾ ਜੀ ਜੀ ਠੀਕ ਹੈ ਜੀ ਮੈਮ ਤੁਸੀਂ ਇੱਕ ਵਾਰੀ ਸਾਡੇ ਆਫਿਸ ਆ ਕੇ ਆਫਿਸ ਆ ਕੇ ਇੱਕ ਵਾਰੀ ਤੁਸੀਂ ਗੱਲ ਕਰ ਸਕਦੇ ਹੋ ਹਾਂਜੀ ਤੁਸੀਂ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਓਕੇ ਮੈਮ